ਅੱਜ ਦੇ ਯੁੱਗ ਵਿੱਚ ਮਨੁੱਖ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਗਏ ਹਨ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਵਹਿਮ ਭਰਮ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਗਿਆ ਹੈ ਅਤੇ ਲੋਕ ਇਹਨਾਂ ਵਹਿਮਾਂ ਭਰਮਾਂ 'ਤੇ ਬਹੁਤ ਵਿਸ਼ਵਾਸ ਕਰਦੇ ਹਨ ਜਿਵੇਂ ਕਿ ਬਿੱਲੀ ਦਾ ਰਸਤਾ ਕੱਟਣਾ ਜਾਉਣ ਵੇਲੇ ਪਿੱਛੇ ਟੋਕਣਾ ਗਧੇ ਦਾ ਹਿਣਕਣਾ ਕੁੱਤਿਆਂ ਦਾ ਰਾਤ ਵੇਲੇ ਰੋਣਾ ਆਦਿ ਬਿੱਲੀ ਦਾ ਰਸਤਾ ਕੱਟਣ ਨਾਲ ਕੰਮ ਪੂਰਾ ਨਹੀਂ ਹੁੰਦਾ ਜਾਂ ਕੰਮ ਵਿੱਚ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਪਿੱਛੋਂ ਆਵਾਜ਼ ਮਾਰਨ ਲਈ ਕਈ ਵਹਿਮ ਕੀਤੀ ਜਾਂਦੀ ਹਨ ਕਿ ਪਿੱਛੋਂ ਆਵਾਜ਼ ਮਾਰਨ ਨਾਲ ਕੰਮ ਸਿਰੇ ਨਹੀਂ ਚੜਦਾ ਰਾਤ ਨੂੰ ਕੁੱਤਿਆਂ ਦੇ ਰੋਣ ਨਾਲ ਇਹ ਵਹਿਮ ਫੈਲਿਆ ਹੈ ਕਿ ਕੁਝ ਨਾ ਕੁਝ ਅਣਹੋਣੀ ਦਾ ਸੰਕੇਤ ਹੈ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਅੱਜ ਵੀ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਅਤੇ ਕਈ ਮੁਸ਼ਕਿਲਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਹੜੀਆਂ ਕਿ ਸਾਡੇ ਜੀਵਨ 'ਤੇ ਪ੍ਰਭਾਵ ਪਾਉਂਦੀਆਂ ਹੈ ਅਤੇ ਸਾਡੇ ਜੀਵਨ ਵਿੱਚ ਅੱਗੇ ਵਧਣ ਦੀ ਇੱਛਾ ਨੂੰ ਰੋਕਦੀਆਂ ਹਨ